ਭਾਂਡਿਆਂ ਤੋਂ ਬਿਨਾਂ ਰਸੋਈ ਦਾ ਤਾਂ ਕੋਈ ਮਹੱਤਵ ਹੀ ਨਹੀਂ ਹੈਗਾ ਕਿਉਂਕਿ ਭਾਂਡੇ ਹੀ ਨੇ ਜਿਹੜੇ ਕਿ ਰਸੋਈ ਨੂੰ ਰਸੋਈ ਦਾ ਰੂਪ ਪ੍ਰਦਾਨ ਕਰਦੇ ਨੇਗੇ ਸਾਡੇ ਆਮ ਵਰਤੋਂ ਵਿੱਚ ਅਸੀਂ ਕਾਫ਼ੀ ਸਾਰੇ ਭਾਂਡਿਆਂ ਦੀ ਵਰਤੋਂ ਕਰਦੇ ਹਾਂ ਜਿਹਦੇ ਵਿੱਚ ਚਮਚਾ ਕੋਲੀ ਗਲਾਸ ਕੜਾਹੀ ਅਤੇ ਪਤੀਲਾ ਆਦਿ ਬਰਤਨ ਅਸੀਂ ਵਰਤੋਂ ਵਿੱਚ ਲੈ ਕੇ ਆਉਂਦੇ ਹਾਂ ਕੁਛ ਵੀ ਅਸੀਂ ਚੀਜ਼ਾਂ ਬਣਾਉਣ ਲਈ ਭਾਂਡਿਆਂ ਦੀ ਵਰਤੋਂ ਕਰਦੇ ਹਾਂ ਇਨ੍ਹਾਂ ਤੋਂ ਹੀ ਅਸੀਂ ਕਾਫੀ ਸਾਰੀਆਂ ਸਬਜ਼ੀਆਂ ਇਨ੍ਹਾਂ ਵਿੱਚ ਬਣਾਉਂਦੇ ਹਾਂ ਇਨ੍ਹਾਂ ਵਿੱਚ ਪਾਣੀ ਰੱਖ ਸਕਦੇ ਹਾਂ ਜਿਹੜੇ ਭਾਂਡੇ ਹੁੰਦੇ ਨੇ ਗੇ ਇਨ੍ਹਾਂ ਵਿੱਚ ਕਾਫ਼ੀ ਕਿਸਮ ਦੇ ਭਾਂਡੇ ਹੁੰਦੇ ਨੇ ਹਰੇਕ ਦਾ ਆਪਣਾ ਆਪਣਾ ਹੀ ਕੰਮ ਹੁੰਦਾ ਜਿਵੇਂ ਕਿ ਪਤੀਲਾ ਹੈ ਪਤੀਲੇ ਵਿੱਚ ਅਸੀਂ ਚਾਹ ਵੀ ਬਣਾ ਸਕਦੇ ਹਾਂ ਪਾਣੀ ਵੀ ਉਬਾਲ ਸਕਦੇ ਹਾਂ ਜਿਹੜੇ ਚਮਚਾ ਆ ਚਮਚੇ ਤੋਂ ਬਿਨਾਂ ਅਸੀ ਕੋਈ ਵੀ ਚੀਜ਼ ਆ ਜਿਹੜਾ ਕੋਈ ਤਰਲ ਪਦਾਰਥ ਆ ਉਹਨੂੰ ਅਸੀਂ ਖਾ ਨਹੀਂ ਸਕਦੇ ਹੈਗੇ ਜਿਹੜੀਆਂ ਕੋਲੀਆਂ ਹੁੰਦੀਆਂ ਨੇ ਉਹਨਾਂ ਵਿੱਚ ਅਸੀਂ ਕੋਈ ਵੀ ਤਰ੍ਹਾਂ ਦਾ ਲੀਕੁਅਡ ਜਾਂ ਕੋਈ ਤਰਲ ਪਦਾਰਥ ਉਨ੍ਹਾਂ ਵਿੱਚ ਪਾ ਦਿੰਦੇ ਹਾਂ ਜਿਹੜੇ ਕਿ ਸਾਨੂੰ ਖਾਣ ਖਾਣ ਵਿੱਚ ਉਹਨਾਂ ਦੀ ਅਸਾਨੀ ਹੋ ਜਾਂਦੀ ਹੈ ਹੁਣ ਜਿਵੇਂ ਗਲਾਸ ਆਉਂਦਾ ਗਲਾਸ ਵਿੱਚ ਅਸੀਂ ਕੋਈ ਵੀ ਤਰਲ ਪਦਾਰਥ ਆਦਿ ਕੋਈ ਵੀ ਅਸੀਂ ਪਾਣੀ ਵਗੈਰਾ ਪਾ ਪਾ ਕੇ ਉਹਦੇ ਵਿੱਚ ਅਸੀਂ ਪੀ ਸਕਦੇ ਹਾਂ ਉਹ ਵੀ ਸਾਡੇ ਲਈ ਬਹੁਤ ਵਧੀਆ ਕੰਮ ਆਉਂਦਾ ਨੇਗੇ ਅਤੇ ਕੜਛੀ ਹੁੰਦੀ ਹੈ ਕੜਛੀਆਂ ਕੋਈ ਵੀ ਸਾਨੂੰ ਸਬਜ਼ੀ ਬਣਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ ਇਹਦੇ ਵਿੱਚ ਕਾਫੀ ਸਾਰੇ ਹੋਰ ਵੀ ਮਸਾਲਿਆਂ ਨੂੰ ਰਲਾਉਣ 'ਚ ਵੀ ਮਦਦ ਕਰਦੀ ਹੈ ਜਿਹੜੀ ਕੜਛੀ ਹੁੰਦੀ ਹੈ ਇਹ ਵੀ ਇੱਕ ਛੋਟੀ ਹੁੰਦੀ ਹੈ ਇੱਕ ਵੱਡੀ ਹੁੰਦੀ ਹੈ ਉਹ ਸਾਰੇ ਆਪਣੇ ਅਲੱਗ ਅਲੱਗ ਤਰ੍ਹਾਂ ਦੇ ਕੰਮ ਕਰਦੇ ਇਹਦੇ ਵਿੱਚ ਖੁਰਚਣਾਂ ਵੀ ਵਰਤਿਆਂ ਜਾਂਦਾ ਖੁਰਚਣਾਂ ਹੁੰਦਾ ਹੈ ਜਿਹੜਾ ਕਿ ਸਾਰੇ ਕੁਛ ਸਬਜ਼ੀਆਂ ਸੁਬਜ਼ੀਆਂ ਹਿਲਾਉਣ ਵਿੱਚ ਸਾਡੀ ਸਹਾਇਤਾ ਕਰਦਾ ਹੈ